ਹੈਲੋ ਸਤਿ ਸ਼੍ਰੀਆਕਾਲ ਮੈਮ ਤੁਸੀਂ ਫਲਿੱਪਕਾਰਟ ਤੋਂ ਬੋਲ ਰਹੇ ਹੋ ਫਲਿੱਪਕਾਰਟ ਮੇਰੇ ਅਕਾਊਂਟ ਤੇ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹਨ ਜੋ ਮੈਂ ਅਜੇ ਖਰੀਦਣਾ ਨਹੀਂ ਚਾਹੁੰਦੀ ਉਹਨਾਂ ਵਿੱਚੋਂ ਜਿਵੇਂ ਰੈਡ ਟੇਪ ਦੇ ਬੂਟ ਰੈਡ ਟੇਪ ਦੀ ਟੀ ਸ਼ਰਟ ਸਨਾਟਾ ਦੀ ਵਾਚ ਹੋਰ ਫੋਨ ਕਵਰਜ਼ ਜੋ ਕੀ ਆਰਡਰ ਕੀਤੇ ਹੋਏ ਹਨ ਜੋ ਕੀ ਮੈਂ ਅਜੇ ਨਹੀਂ ਖਰੀਦਣਾ ਚਾਹੁੰਦੀ ਇਹਨਾਂ ਵਿੱਚੋਂ ਜਿਵੇਂ ਲੈਪਟੋਪ ਸੂਟ ਬਹੁਤ ਸਾਰੇ ਇਹੋ ਜਿਹੀਆਂ ਆਰਡਰ ਕੀਤੀਆਂ ਹੋਈਆਂ ਚੀਜ਼ਾਂ ਜੋ ਅਜੇ ਮੈਂ ਨਹੀਂ ਖਰੀਦਣਾ ਚਾਹੁੰਦੀ ਕਿਰਪਾ ਕਰਕੇ ਇਹਨਾਂ ਆਈਟਮਾਂ ਨੂੰ ਡਿਲੀਟ ਕਰ ਕੀਤਾ ਜਾਵੇ ਜੋ ਜਦੋਂ ਮੈਨੂੰ ਲੋੜ ਹੋਈ ਵੀ ਕੋਈ ਵੀ ਚੀਜ਼ ਖਰੀਦਣ ਲਈ ਮੈਨੂੰ ਲੋੜ ਹੋਈ ਮੈਂ ਆਪ ਉਹਨਾਂ ਚੀਜ਼ਾਂ ਨੂੰ ਆਰਡਰ ਕਰ ਲਵਾਂਗੀ ਕਿਰਪਾ ਕਰਕੇ ਇਹ ਜਿਹੜੀਆਂ ਚੀਜ਼ਾਂ ਆਰਡਰ ਕੀਤੀਆਂ ਹੋਈਆਂ ਹਨ ਕਿਰਪਾ ਕਰਕੇ ਇਹਨਾਂ ਨੂੰ ਡਿਲੀਟ ਕੀਤਾ ਜਾਵੇ